ਜਿਵੇਂ ਕਿ ਗ੍ਰਹਿਆਂ 'ਤੇ ਜੀਵਨ ਵਿੱਚ ਗੱਲ ਆਉਂਦੀ ਹੈ ਵੀ ਕਿਸੇ ਵੀ ਗ੍ਰਹਿ 'ਤੇ ਜੀਵਨ ਸੰਭਵ ਹੈ ਜਾਂ ਨਹੀਂ ਹੈ ਵੀ ਜਿੱਥੋਂ ਤੱਕ ਮੈਂ ਸਾਰਾ ਕੁਛ ਪੜ੍ਹਿਆ ਹੋਇਆ ਵੀ ਮੇਰਾ ਗਿਆਨ ਆ ਮੈਨੂੰ ਇਹ ਲੱਗਦਾ ਵੀ ਜਿੰਨੇ ਵੀ ਵਿਗਿਆਨੀਆਂ ਨੇ ਖੋਜ ਕੀਤੀ ਹੈ ਜਿਵੇਂ ਕਿ ਉਹਨਾਂ ਨੇ ਚੰਨ ਦੀ ਖੋਜ ਕੀਤੀ ਆ ਚੰਨ 'ਤੇ ਵੀ ਥੋੜ੍ਹਾ ਬਹੁਤਾ ਪਾਣੀ ਤਾਂ ਹੈ ਪਰ ਉੱਥੇ ਗੁਰੂਤਾ ਬਲ ਸੰਭਵ ਨਹੀਂ ਹੋਰ ਜਿੰਨੇ ਵੀ ਵਿਗਿਆਨੀਆਂ ਨੇ ਗ੍ਰਹਿਆਂ 'ਤੇ ਰਹਿਣ ਦੀ ਜਾਂ ਜੀਵਨ ਨਿਰਬਾਹ ਕਰਨ ਦੀ ਵੀ ਖੋਜਾਂ ਕੀਤੀਆਂ ਉਹਨਾਂ ਦੇ ਅਨੁਸਾਰ ਜਿੰਨਾ ਕੁ ਮੈਂ ਪੜ੍ਹਿਆ ਮੈਨੂੰ ਇਹ ਲੱਗਦਾ ਕਿ ਉਹਨਾਂ ਉਹਨਾਂ ਗ੍ਰਹਿਆਂ 'ਤੇ ਰਹਿਣਾ ਉੱਨਾਂ ਸੰਭਵ ਨਹੀਂ ਵੀ ਜਿੰਨਾ ਜਿਹੜਾ ਧਰਤੀ ਗ੍ਰਹਿ 'ਤੇ ਰਹਿਣਾ ਸੰਭਵ ਕਿਉਂਕਿ ਉੱਥੇ ਪਾਣੀ ਦੀ ਬਹੁਤ ਘੱਟ ਮਾਤਰਾ ਪਾਈ ਜਾਂਦੀ ਹੈ ਚੰਨ 'ਤੇ ਥੋੜ੍ਹੀ ਬਹੁਤੀ ਪਾਈ ਜਾਂਦੀ ਉਹਦੇ 'ਚ ਵੀ ਗੁਰੂਤਾ ਅਕਰਸ਼ਣ ਨਹੀਂ ਮਿਲਦਾ ਆਪਾਂ ਨੂੰ ਅਤੇ ਪਾਣੀ ਦੀ ਘੱਟ ਮਾਤਰਾ ਹੋਣ ਕਾਰਨ ਮੈਨੂੰ ਇਹ ਲੱਗਦਾ ਕਿ ਮੇਰਾ ਵਿਚਾਰ ਇਹ ਆ ਕਿ ਹੋਰਨਾ ਗ੍ਰਹਿਆਂ 'ਤੇ ਰਹਿਣਾ ਸੰਭਵ ਨਹੀਂ ਹੈ